ਅਸੀਂ ਦੇਖ ਰਹੇ ਹਾਂ ਇਤਿਹਾਸ ਇੰਡੀਆ ਵਰਗੇ ਮੁਲਕ ਵਿੱਚ ਲੋਕਾਂ ਦੀ ਬੜੀ ਵੱਡੀ ਸਾਂਝ ਹੈ ਇਹਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਆ ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਨੇ ਚਾਹੇ ਹਿੰਦੂ ਹੈ ਮੁਸਲਿਮ ਹੈ ਸਿੱਖ ਇਸਾਈ ਨੇ ਸਾਰੇ ਆਪਸ ਵਿੱਚ ਬੜੇ ਪਿਆਰ ਨਾਲ ਰਹਿ ਰਹੇ ਨੇ ਅਤੇ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ ਅਤੇ ਬੜਾ ਵਧੀਆ ਪਿਆਰ ਹੈ ਇਹਨਾਂ ਦਾ ਆਪਸ 'ਚ ਅਤੇ ਇਹ ਜਿਹੜੇ ਇੱਕ ਦੂਜੇ ਨਾਲ ਅਸੀਂ ਦੇਖਿਆ ਵੀ ਜਿਹੜੇ ਇਹਨਾਂ ਦੇ ਜਿਵੇਂ ਸਿੱਖਾਂ ਦੇ ਤਿਉਹਾਰ ਆ ਉਹਨਾਂ ਵਿੱਚ ਹਿੰਦੂ ਵੀ ਸ਼ਿਰਕਤ ਕਰਦੇ ਨੇ ਅਤੇ ਜਿਹੜੇ ਹੋਰ ਧਰਮ ਨੇ ਜਿਵੇਂ ਹਿੰਦੂਆਂ ਦਾ ਧਰਮ ਮੰਦਰਾਂ ਵਿੱਚ ਸਿੱਖ ਵੀ ਉਹਨਾਂ ਦੇ ਕਈ ਤਿਉਹਾਰਾਂ ਦੇ ਮੌਕੇ ਜਿਵੇਂ ਸ਼ਿਵਰਾਤਰੀ ਆ ਉਹਨਾਂ ਨਾਲ ਪਿਆਰ ਸੰਦੇਹ ਪੂਰਾ ਬਣਾਉਂਦੇ ਨੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਮੁਸਲਿਮ ਧਰਮ ਵਿੱਚ ਵੀ ਜਦੋਂ ਈਦ ਨਵਾਜ਼ ਹੁੰਦੀ ਹੈ ਸਿੱਖ ਉਹਨਾਂ ਨੂੰ ਚਾਹੇ ਹਿੰਦੂ ਹੋਣਾ ਪੂਰੀ ਤਰ੍ਹਾਂ ਉਹਨਾਂ ਨੂੰ ਵਧਾਈ ਦਿੰਦੇ ਨੇ ਅਤੇ ਇਸੇ ਤਰ੍ਹਾਂ ਮਤਲਬ ਸਰਬ ਸਾਂਝੀਵਾਲਤਾ ਦਾ ਸੰ ਸੰਦੇਸ਼ ਮਿਲਦਾ ਇਸ ਤਰ੍ਹਾਂ ਅਸੀਂ ਇੰਡੀਆ ਜਿਹੜਾ ਇੱਕ ਲੋਕਤੰਤਰੀ ਦੇਸ਼ ਹੈ ਇਹਦੇ ਵਿੱਚ ਬੜੇ ਪਿਆਰ ਨਾਲ ਰਹਿ ਰਹੇ ਨੇ ਇੱਕ ਦੂਜੇ ਨਾਲ ਅਤੇ ਰਹਿਣਾ ਵੀ ਚਾਹੀਦਾ ਕਿਉਂਕਿ ਜਿਹੜੇ ਧਰਮ ਹੈ ਧਰਮ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਸਿਖਾਉਂਦਾ ਅਤੇ ਵੈਰ ਵਿਰੋਧ ਰੱਖਣਾ ਵੀ ਨਹੀਂ ਚਾਹੀਦਾ ਮਿਲ ਜੁਲ ਕੇ ਰਹਿਣਾ ਚਾਹੀਦਾ ਇੰਡੀਆ ਇਸ ਲਈ ਬਹੁਤ ਜਾਤ ਪਾਤ ਤੋਂ ਉੱਪਰ ਉੱਠ ਕੇ ਤਰੱਕੀ ਕਰ ਰਿਹਾ